ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਜੀ ਹਾਂਜੀ ਹੋਰ ਘਰ ਸਾਰੇ ਠੀਕ ਨੇ ਹਾਂਜੀ ਅਤੇ ਵੀਰ ਜੀ ਮੈਂ ਤੁਹਾਨੂੰ ਆਇਆ ਦੀ ਸੀਗੀ ਹੁਣ ਸਾਨੂੰ ਛੁੱਟੀਆਂ ਹੋਈਆਂ ਸੀਗੀਆਂ ਗਰਮੀ ਦੀਆਂ ਅਤੇ ਅਸੀਂ ਤੁਹਾਡੇ ਸ਼ਹਿਰ ਘੁੰਮਣ ਫਿਰਨ ਆਉਣਾ ਸੀ ਅਤੇ ਮੇਰੇ ਬ੍ਰਦਰ ਸ ਸਿਸਟਰ ਛੋਟੇ ਉਹ ਵੀ ਨਾਲ ਆਉਂਣਗੇ ਹਾਂਜੀ ਅਤੇ ਤੁਸੀਂ ਸਾਨੂੰ ਦੱਸ ਦਿਓ ਵੀ ਤੁਹਾਡੇ ਸ਼ਹਿਰ ਦੇ ਵਿੱਚ ਕਿਹੜੀਆਂ ਫੇਮਸ ਉਹ ਨੇ ਜਗ੍ਹਾ ਨੇ ਜਿੱਥੇ ਆਪਾਂ ਘੁੰਮਣ ਫਿਰਨ ਲਈ ਜਾ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੰਨੇ ਨਾਲ ਐਂ ਹੋ ਜਾਂਦਾ ਨਾ ਵੀ ਘੁੰਮ ਫਿਰ ਕੇ ਚੱਲੋ ਮੂਵੀ ਵੇਖਣ ਨਾਲ ਮਾੜਾ ਜਿਹਾ ਆਪਣਾ ਮਾਇੰਡ ਵੀ ਸਹੀ ਹੋ ਜਾਂਦਾ ਅਤੇ ਡਿਨਰ ਵੀ ਆਪਾਂ ਫਿਰ ਬਾਹਰ ਹੀ ਕਰ ਜਾਂਗੇ ਸਾਰਾ ਦਿਨ ਘੁੰਮਣ ਫਿਰਨ 'ਤੇ ਲੱਗੂਗਾ ਥੱਕੇ ਹੋਵਾਂਗੇ ਹਾਂਜੀ ਹਾਂਜੀ ਠੀਕ ਹੈ ਫਿਰ ਵੀਰ ਜੀ ਅਸੀਂ ਆਵਾਂਗੇ ਤਾਂ ਤੁਹਾਨੂੰ ਦੱਸ ਦਾਂਗੇ ਅਤੇ ਫਿਰ ਆਪਾਂ ਪਲੈਨ ਬਣਾ ਲਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ